ਅਸੀਂ ਆਪਣੇ ਨੇੜੇ ਗੁਰਦੁਆਰਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾਂਦੇ ਹਨ ਜਿੱਥੇ ਛੋਟੇ ਸ਼ਾ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਸੀ ਅਸੀਂ ਉੱਥੇ ਜਾਂਦੇ ਹਾਂ ਸਾਨੂੰ ਜਦੋਂ ਵੀ ਸਮਾਂ ਮਿਲਦਾ ਹੈ ਅਸੀਂ ਉੱਥੇ ਜਾ ਕੇ ਦਰਸ਼ਨ ਕਰਕੇ ਆਉਂਦੇ ਹਨ ਉੱਥੇ ਜਾ ਕੇ ਸਾਨੂੰ ਜਿਹੜਾ ਸਭ ਤੋਂ ਬੜਾ ਅਨੁਭਵ ਹੁੰਦਾ ਏ ਕਿ ਛੋਟੀ ਉਮਰੇ ਉਹਨਾਂ ਨੇ ਵੱਡੀਆਂ ਸ਼ਹਾਦਤਾਂ ਦੇ ਦਿੱਤੀਆਂ ਕਿ ਕਿਵੇਂ ਕਿਸੇ ਅੱਗੇ ਸਾਨੂੰ ਝੁੱਕ ਕੇ ਨਹੀਂ ਰਹਿਣਾ ਚਾਹੀਦਾ ਕਿਸੇ ਜ਼ਾਲਮ ਅੱਗੇ ਸਾਨੂੰ ਝੁਕਣਾ ਨਹੀਂ ਚਾਹੀਦਾ ਹਮ ਸਾਨੂੰ ਹਮੇਸ਼ਾ ਹੱਕ ਸੱਚ ਦਾ ਸਾਥ ਦੇਣਾ ਚਾਹੀਦਾ ਜਦੋਂ ਕਿਸੇ ਮਾੜੇ 'ਤੇ ਸ ਜ਼ੁਲਮ ਹੁੰਦਾ ਦੇਖਦਾ ਸਾਨੂੰ ਉਹ ਤਾਂ ਜ਼ੁਲਮ ਹੁੰਦਾ ਨਹੀਂ ਦੇਖਣਾ ਚਾਹੀਦਾ ਸਾਨੂੰ ਹੱਕ ਸੱਚ ਦਾ ਸਾਥ ਦੇਣਾ ਚਾਹੀਦਾ ਕਿਸੇ ਅੱਗੇ ਸਾਨੂੰ ਗੋਡੇ ਨਹੀਂ ਟੇਕਣੇ ਚਾਹੀਦੇ